ਕਾਰੋਬਾਰ ਵਿੱਚ ਤਕਨੀਕੀ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਕੰਪਿਊਟਰ ਨੂੰ ਹੀ ਦੇਖ ਲਓ ਕੰਪਿਊਟਰ ਅੱਜ ਕੱਲ੍ਹ ਬਹੁਤ ਹੀ ਜ਼ਰੂਰੀ ਹੋ ਗਿਆ ਹੈ ਇਸ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਏਅਰਪੋਰਟ ਉੱਤੇ ਟਿਕਟਾਂ ਟਰੇਨਾਂ ਦੀਆਂ ਟਿਕਟਾਂ ਸਕੂਲਾਂ ਵਿੱਚ ਬੱਚਿਆਂ ਲਈ ਅਤੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਵੀ ਬਹੁਤ ਜ਼ਰੂਰੀ ਹੈ ਇਸ ਦੇ ਜ਼ਰੀਏ ਆਪਾਂ ਬਹੁਤ ਹੀ ਜ਼ਿਆਦਾ ਕੰਮ ਕਾਰ ਕਰ ਸਕਦੇ ਹਾਂ ਕੰਪਿਊਟਰ ਸਾਡੇ ਲਈ ਇੱਕ ਉਹ ਚੀਜ਼ ਹੈ ਜਿਹਦੇ ਨਾਲ ਸਾਡਾ ਕਾਰੋਬਾਰ ਵੀ ਵਧਾਇਆ ਜਾ ਸਕਦਾ ਹੈ ਤਕਨੀਕੀ ਦੇ ਜ਼ਰੀਏ ਅਸੀਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਵੀ ਕੱਢ ਸਕਦੇ ਹਾਂ ਜੋ ਚੀਜ਼ ਸਾਨੂੰ ਕਿਸੇ ਤੋਂ ਨਹੀਂ ਪਤਾ ਲੱਗਦੀ ਉਹ ਅਸੀਂ ਇਸ ਉੱਪਰ ਦੇਖ ਸਕਦੇ ਹਾਂ ਕੰਪਿਊਟਰ ਦੇ ਜ਼ਰੀਏ ਸਾਨੂੰ ਬਹੁਤ ਕੁਝ ਵੀ ਸਿੱਖਣ ਨੂੰ ਮਿਲਦਾ ਹੈ